ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਚਾਰ ਜੂਨ ਉੱਨੀ ਸੌ ਸੱਠ ਇੱਕ ਦਸੰਬਰ ਉੱਨੀ ਸੌ ਛੱਬੀ ਪੰਜ ਜਨਵਰੀ ਦੋ ਹਜ਼ਾਰ